ਜੀ ਹਾਂ ਕਲਾ ਅਤੇ ਸ਼ਿਲਪਕਾਰੀ ਇੱਕ ਐਸੀ ਸ਼ੈਅ ਹੈ ਜੋ ਹਰ ਇੱਕ ਦੇ ਮਨ ਨੂੰ ਖਿੱਚਣ ਵਿੱਚ ਵੱਡੀ ਭੂਮਿਕਾ ਅਦਾ ਕਰਦੀ ਹੈ ਹੁਣ ਸੈਰ ਸਪਾਟਾ ਅਸੀਂ ਕਰਦੇ ਹੀ ਕਿਉਂ ਹਾਂ ਕਿਉਂ ਅਸੀਂ ਆਪਣੇ ਘਰ ਤੋਂ ਇੱਕ ਵੱਖਰਾ ਮਾਹੌਲ ਚਾਹੁੰਦੇ ਹਾਂ ਜੋ ਸਾਨੂੰ ਦਿਲ ਖਿਚਵਾਂ ਲੱਗੇ ਅਕਰਸ਼ਿਤ ਲੱਗੇ ਅਸੀਂ ਉਹ ਥਾਵਾਂ 'ਤੇ ਜੇਕਰ ਜੇ ਅਸੀਂ ਪਹਾੜੀ ਖੇਤਰਾਂ 'ਚ ਵੀ ਜਾਂਦੇ ਹਾਂ ਨਾ ਤਾਂ ਉੱਥੇ ਆਟੋਮੈਟਿਕ ਜਾਂ ਅਸੀਂ ਕਹਿ ਸਕਦੇ ਹਾਂ ਕਿ ਕੁਦਰਤੀ ਅਦਭੁਤ ਸੀਨਰੀਆਂ ਅਦਭੁਤ ਕਲਾ ਅਦਭੁਤ ਸ਼ਿਲਪਕਾਰੀ ਸਾਨੂੰ ਨਜ਼ਰ ਆਉਂਦੀ ਹੈ ਤਾਂ ਹੁਣ ਜਦੋਂ ਅਸੀਂ ਕੋਈ ਚੀਜ਼ ਦੇਖਣ ਜਾਂਦੇ ਹਾਂ ਤਾਂ ਸਾਨੂੰ ਜਿੱਥੇ ਵੱਧ ਤੋਂ ਵੱਧ ਕਲਾਮਕਤਾ ਹੈ ਉਹੀ ਚੰਗੀ ਲੱਗਦੀ ਹੈ ਕੋਈ ਇਸ ਤਰ੍ਹਾਂ ਦਾ ਪਾਰਕ ਬਣਿਆ ਹੋਇਆ ਹੈ ਜਿੱਥੇ ਵੇਲ ਬੂਟੇ ਹੀ ਇਸ ਤਰ੍ਹਾਂ ਲੱਗੇ ਹੋਏ ਨੇ ਕੋਈ ਬੱਚੇ ਆ ਉੱਥੇ ਹਾਥੀ ਬਣਿਆ ਹੋਇਆ ਹਾਥੀ ਦੇ ਉੱਤੇ ਹੀ ਗਮਲੇ ਸਜਾਏ ਹੋਏ ਨੇ ਤਾਂ ਬੱਚਿਆਂ ਨੂੰ ਚੰਗੇ ਲੱਗਦੇ ਨੇ ਉਹਨਾਂ ਦੀ ਖਿੱਚ ਦਾ ਕਾਰਨ ਬਣਦਾ ਤਾਂ ਪੰਜਾਬ ਦੇ ਵਿੱਚ ਤਾਂ ਖਾਸ ਤੌਰ 'ਤੇ ਜੇ ਅਸੀਂ ਦੇਖੀਏ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਡੇ ਕੁਝ ਥਾਵਾਂ ਬਣੀਆਂ ਹੋਈਆਂ ਨੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਸਾਡਾ ਪਿੰਡ ਬਣਿਆ ਹੋਇਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਇਸ ਤਰ੍ਹਾਂ ਦੇ ਪਾਰਕ ਯੂ ਕੇਂਦਰ ਬਣੇ ਹੋਏ ਨੇ ਜਿੱਥੇ ਬੜੀਆਂ ਸੋਹਣੀਆਂ ਸੋਹਣੀਆਂ ਜਿਹੜੀਆਂ ਪਟਿਆਲਾ ਸ਼ਹਿਰ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਮਹਿਲ ਨੇ ਜਿਹਨਾਂ ਨੂੰ ਮੋਤੀ ਮਹਿਲ ਵਰਗੇ ਮਹਿਲ ਜਿੱਥੇ ਤੁਸੀਂ ਸ਼ਿਲਪਕਾਰੀ ਨੂੰ ਦੇਖਦੇ ਹੋ ਤਾਂ ਦੇਖਦੇ ਹੀ ਰਹਿ ਜਾਂਦੇ ਹੋ ਸਾਡੇ ਬਹੁਤ ਸਾਰੇ ਗੁਰੂ ਘਰ ਇਹੋ ਜਿਹੇ ਨੇ ਜਿੱਥੇ ਬੁੱਤ ਘੜ ਇੰਨੇ ਸੋਹਣੀਆਂ ਬੁੱਤ ਘੜ ਤਸਵੀਰਾਂ ਬਣੀਆਂ ਹੋਈਆਂ ਨੇ ਮੁਦਕੀ ਦੇ ਨੇੜੇ ਸਾਡੇ ਇੱਕ ਬਣਿਆ ਹੋਇਆ ਹੈ ਇਤਿਹਾਸਿਕ ਸਥਾਨ ਉਸ ਨੂੰ ਵੇਖੀਏ ਤਾਂ ਉਹ ਤਸਵੀਰਾਂ ਇੰਜ ਲੱਗਦੀਆਂ ਜਿਵੇਂ ਮੂੰਹੋਂ ਬੋਲਦੀਆਂ ਹੋਣ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇੱਕ ਵੱਡੀ ਭੂਮਿਕਾ ਨਿਭਾਉਂਦੀਆਂ ਨੇ ਸੈਲਾਨੀਆਂ ਨੂੰ ਖਿੱਚਣ ਲਈ ਆਕਰਸ਼ਿਤ ਕਰਨ ਲਈ ਸੈਰ ਸਪਾਟਾ ਤਾਂ ਮੈਨੂੰ ਲੱਗਦਾ ਖੜ੍ਹਾ ਹੀ ਕਲਾ ਅਤੇ ਸ਼ਿਲਪਕਾਰੀ 'ਤੇ ਹੈ ਜਿੱਥੇ ਵੀ ਤੁਹਾਨੂੰ ਵਧੇਰੇ ਕਲਾ ਵਧੇਰੇ ਸ਼ਿਲਪਕਾਰੀ ਮਿਲਦੀ ਹੈ ਉੱਥੇ ਅਸੀਂ ਜਾਂਦੇ ਹੀ ਜਾਂਦੇ ਹਾਂ ਹੁਣ ਨਜ਼ਦੀਕ ਜਿਹੀ ਦੀ ਗੱਲ ਕਰ ਲਈਏ ਕਿ ਲੁਧਿਆਣੇ ਦੇ ਨੇੜੇ ਹੀ ਇੱਕ ਸ਼ਹਿਰ ਹੈ ਮੇਰੇ ਜਲਦੀ ਦੇ ਵਿੱਚ ਉਹਦਾ ਨਾਮ ਜਿਹਨ 'ਚ ਨਹੀਂ ਆ ਰਿਹਾ ਹਾਂ ਉੱਥੇ ਇੱਕ ਅਧਿਆਪਕ ਹੈਗੇ ਜਿਹਨਾਂ ਨੇ ਆਪਣੀ ਹੱਥ ਪੇਂਟਿੰਗ ਰਾਹੀਂ ਨਾ ਇੱਕ ਰੈਸਟੋਰੈਂਟ ਖੋਲ੍ਹ ਲਿਆ ਅਤੇ ਹੱਥ ਪੇਂਟਿੰਗ ਉਹਨਾਂ ਨੇ ਲਾਈਆਂ ਹੋਈਆਂ ਉੱਥੇ ਅਤੇ ਉਹ ਇੰਨਾ ਮਕਬੂਲ ਹੋਇਆ ਇਸ ਟਾਈਮ ਕਿ ਹਰ ਕੋਈ ਉੱਧਰ ਨੂੰ ਜਾਣ ਵਾਲਾ ਵਿਅਕਤੀ ਸਪੈਸ਼ਲ ਉੱਥੇ ਜਾ ਕੇ ਆਉਂਦਾ ਹੈ ਉਸ ਨੂੰ ਵੇਖਣ ਲਈ ਜਾਂਦਾ ਹੈ ਕਾਰਨ ਕੀ ਹੈ ਕਿ ਸਿਰਫ ਓਥੇ ਹੱਥ ਨਾਲ ਬਣਾਈਆਂ ਹੋਈਆਂ ਪੇਂਟਿੰਗਸ ਨੇ ਹੋਰ ਕੋਈ ਵੀ ਚੀਜ਼ ਤੁਹਾਨੂੰ ਉਥੇ ਨਜ਼ਰ ਨਹੀਂ ਆਉਂਦੀ ਤਾਂ ਆਪਣੇ ਆਪ ਹੀ ਉਹ ਆਕਰਸ਼ਣ ਦਾ ਕਾਰਨ ਬਣ ਗਿਆ ਇਸ ਤਰ੍ਹਾਂ ਹੀ ਸਾਡੇ ਸਕੂਲ ਕਾਲਜ ਅੱਜ ਕੱਲ੍ਹ ਕਿੰਨੇ ਸੋਹਣੇ ਬਣ ਰਹੇ ਹਨ ਅਸੀਂ ਉਹਨਾਂ ਨੂੰ ਸੋਹਣੇ ਕਿਉਂ ਬਣਾਉਂਦੇ ਹਾਂ ਕਿਉਂਕਿ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਆਕਰਸ਼ਣ ਪੈਦਾ ਕਰਨ ਸੋ ਕਲਾ ਦਾ ਪਹਿਲਾ ਜਿਹੜਾ ਮਨੋਰਥ ਹੈ ਉਹ ਹੈ ਹੀ ਆਕਰਸ਼ਣ ਹੈ ਹੈ ਹੀ ਖਿੱਚਣਾ ਹੈ ਸੋ ਅਸੀਂ ਇਸ ਨੂੰ ਸੈਰ ਸਪਾਟੇ ਦੇ ਉਦਯੋਗ ਨਾਲੋਂ ਤਾਂ ਬਿਲਕੁਲ ਵੱਖ ਹੀ ਨਹੀਂ ਕਰ ਸਕਦੇ ਮੈਂ ਕਹਾ ਕਿ ਜਿੰਦ 'ਤੇ ਸਾਹਾਂ ਵਾਲਾ ਨਾਤਾ ਹੈ ਜੇ ਬੰਦੇ ਦੀ ਜਿੰਦ 'ਚੋਂ ਸਾਹ ਕੱਢ ਦਈਏ ਤਾਂ ਕੁਝ ਵੀ ਬਾਕੀ ਨਹੀਂ ਹੈ ਸੋ ਜੇ ਸੈਰ ਸਪਾਟੇ 'ਚੋਂ ਅਸੀਂ ਕਲਾ ਅਤੇ ਸ਼ਿਲਪਕਾਰੀ ਕੱਢ ਦਈਏ ਤਾਂ ਸਾਡੇ ਪਿੱਛੇ ਬਚਦਾ ਹੀ ਕੁਛ ਨਹੀਂ ਸੋ ਸੈਲਾਨੀਆਂ ਦਾ ਆਕਰਸ਼ਣ ਲਈ ਕਲਾ ਅਤੇ ਸ਼ਿਲਪਕਾਰੀ ਦਾ ਵਧੇਰੇ ਹੋਣਾ ਵਧੇਰੇ ਲਾਜ਼ਮੀ ਹੈ ਅਸੀਂ ਦੇਖਦੇ ਹਾਂ ਕਿ ਰਾਜਸਥਾਨ ਦੇ ਵਿੱਚ ਜੈਪੁਰ ਦੇ ਵਿੱਚ ਜਿਹੜੇ ਮਹਿਲ ਨੇ ਉਹ ਦੇਖੇ ਜਾਂਦੇ ਨੇ ਕਾਰਨ ਕੀ ਹੈ ਕਾਰਨ ਉੱਥੋਂ ਦੀ ਸ਼ਿਲਪਕਾਰੀ ਉੱਥੇ ਕੀਤੀ ਗਈ ਕਲਾਕਾਰੀ ਸੋ ਕਲਾ ਅਤੇ ਸ਼ਿਲਪਕਾਰੀ ਨੂੰ ਮੈਂ ਇੱਕ ਅਟੁੱਟ ਰਿਸ਼ਤਾ ਕਹਿ ਸਕਦੀ ਹਾਂ ਸੈਰ ਸਪਾਟੇ ਲਈ ਸੋ ਸਾਨੂੰ ਪੰਜਾਬ ਦੇ ਵਿੱਚ ਇਸਦਾ ਜਿਹੜਾ ਵੱਧ ਤੋਂ ਵੱਧ ਪ੍ਰਯੋਗ ਕਰਕੇ ਪੰਜਾਬ ਦੇ ਸੈਰ ਸਪਾਟੇ ਦੇ ਉਦਯੋਗ ਦੇ ਵਿੱਚ ਅਸੀਂ ਵੱਧ ਤੋਂ ਵੱਧ ਵਾਧਾ ਕਰ ਸਕਦੇ ਹਾਂ